ਮੈਂ ਫਲਿਪਕਾਰਟ ਤੋਂ ਬੂਟ ਅਤੇ ਰਿੰਗ ਲਾਈਟ ਔਡਰ ਕੀਤੀ ਸੀ ਦੋਨਾਂ ਚੀਜ਼ਾਂ ਦਾ ਔਡਰ ਮੈਂ ਪੰਜ ਅਪ੍ਰੈਲ ਦੋ ਹਜ਼ਾਰ ਚੌਵੀ ਨੂੰ ਕੀਤਾ ਸੀ ਬੂਟ ਮੇਰੇ ਤੱਕ ਉੱਨੀ ਅਪ੍ਰੈਲ ਨੂੰ ਪਹੁੰਚਣੇ ਸਨ ਅਤੇ ਰਿੰਗ ਲਾਈਟ ਤੇਈ ਅਪ੍ਰੈਲ ਨੂੰ ਪਹੁੰਚਣੀ ਸੀ ਉੱਨੀ ਅਪ੍ਰੈਲ ਨੂੰ ਮੇਰੇ ਬੂਟਾਂ ਦਾ ਔਡਰ ਮੇਰੇ ਤੱਕ ਸਹੀ ਪਹੁੰਚ ਗਿਆ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਮੇਰਾ ਔਡਰ ਮੇਰੇ ਤੱਕ ਸਹੀ ਸਲਾਮਤ ਪਹੁੰਚ ਗਿਆ ਹੈ ਅਤੇ ਇਸ ਦੀ ਕੁਆਲਿਟੀ ਵੀ ਵਧੀਆ ਰਹੀ ਤੀਹ ਅਪ੍ਰੈਲ ਨੂੰ ਰਿੰਗ ਲਾਈਟ ਵੀ ਮੇਰੇ ਤੱਕ ਪਹੁੰਚ ਗਈ ਪਰ ਜਦੋਂ ਮੈਂ ਇਹ ਔਡਰ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਰਿੰਗ ਲਾਈਟ ਇੱਕ ਜਗ੍ਹਾ ਤੋਂ ਟੁੱਟੀ ਹੋਈ ਸੀ ਇਸ ਨਾਲ ਮੈਨੂੰ ਬਹੁਤ ਹੀ ਨਿਰਾਸ਼ਾ ਹੋਈ ਕਿਉਂਕਿ ਇਹ ਰਿੰਗ ਲਾਈਟ ਮੈਂ ਆਪਣੇ ਭਰਾ ਨੂੰ ਤੋਹਫ਼ੇ ਵਜੋਂ ਦੇਣੀ ਸੀ ਕਿਉਂਕਿ ਤੇਈ ਤਰੀਕ ਨੂੰ ਉਸ ਦਾ ਜਨਮਦਿਨ ਸੀ ਹੁਣ ਮੇਰੇ ਕੋਲ ਨਾ ਤਾਂ ਰਿੰਗ ਲਾਈਟ ਲੈਣ ਦਾ ਸਮਾਂ ਸੀ ਅਤੇ ਨਾ ਹੀ ਔਨਲਾਈਨ ਔਡਰ ਕਰ ਸਕਦਾ ਸੀ ਇਸ ਲਈ ਮੇਰੇ ਭਰਾ ਨੂੰ ਦੇਣ ਲਈ ਮੇਰੇ ਕੋਲ ਕੋਈ ਵੀ ਤੋਹਫ਼ਾ ਨਹੀਂ ਸੀ ਇਸ ਲਈ ਹੁਣ ਮੇਰਾ ਔਨਲਾਈਨ ਮਾਧਿਅਮ ਨਾਲ ਖ਼ਰੀਦਦਾਰੀ ਕਰਨ ਨੂੰ ਮਨ ਨਹੀਂ ਕਰਦਾ